ਹੈਲ ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਠਾਕ ਹੈ ਹਾ ਹਾਂ ਪਹਿਚਾਣ ਲਿਆ ਪਹਿਚਾਣ ਲਿਆ ਹਾ ਪਹਿਚਾਣ ਲਿਆ ਕੇ ਕਿਹੜੀ ਕਲਾਸ ਕਿਹੜੀ ਆ ਕਲਾਸ ਕੇ ਕਲਾਸ ਕਿਹੜੀ ਹਾਂ ਹਾਂ ਵੈਸੇ ਗੋਲਡਨ ਮੋਲਡ ਸਕੂਲ ਹੀ ਬੈਸਟ ਹੈ ਮੇਰੇ ਹਿਸਾਬ ਨਾਲ ਤਾਂ ਸ਼ਹਿਰ ਦੇ ਵਿੱਚ ਆ ਨਾਲੇ ਅਤੇ ਅਪ ਆਪਣੇ ਬੱਚੇ ਵੀ ਉੱਥੇ ਪੜ੍ਹੇ ਆ ਓ ਓ ਉਹ ਹੀ ਮੈਂ ਤਾਂ ਰੇਕੁਮੈਂਡ ਕਰਨਾ ਫੀਸ ਵੀ ਇਹਨਾਂ ਦੀ ਠੀਕ ਹੈ ਬਾਕੀਆਂ ਦੇ ਕੰਪੈਰੇਟੇਵਲੀ ਹੋਰ ਵੀ ਕਾਫ਼ੀ ਸਕੂਲ ਹੈਗੇ ਇੱਦਾ ਦੂਨ ਸਕੂਲ ਹੈਗਾ ਵਾ ਐੱਚ ਆਰ ਏ ਸਕੂਲ ਆ ਇਹਨਾਂ ਸਕੂਲਾਂ 'ਚ ਫੀ ਫੀਸਾਂ ਜ਼ਿਆਦਾ ਨੇ ਕਾਫ਼ੀ ਜ਼ਿਆਦਾ ਨੇ ਇਹਨਾਂ ਦੀਆਂ ਫੀਸਾਂ ਦਿੱਲੀ ਪਬਲਿਕ ਸਕੂਲ ਵੀ ਹੈਗਾ ਵਾ ਪਰ ਜੇ ਤੁਸੀਂ ਫੀਸ ਦੀ ਗੱਲ ਕਰੋ ਤਾਂ ਫਿਰ ਮੇਰੇ ਹਿਸਾਬ ਨਾਲ ਤਾਂ ਗੋਲਡਨ ਪਬਲਿਕ ਸਕੂਲ ਜਿਹੜਾ ਨਾ ਬੈਸਟ ਬੈਸਟ ਆ ਅਤੇ ਪੜ੍ਹਾਈ ਤਾਂ ਠੀਕ ਆ ਪੜ੍ਹਾਈ ਠੀਕ ਆ ਬੱਚੇ ਤੁਹਾਨੂੰ ਦੱਸਿਆ ਨਾ ਆਪਣੇ ਵੀ ਉੱਥੇ ਪੜ੍ਹੇ ਆ ਬਿਲਕੁਲ ਠੀ ਠੀਕ ਆ ਨਾਲੇ ਸ਼ਹਿਰ ਦੇ ਵਿੱਚ ਪੈ ਜਾਂਦਾ ਅਤੇ ਠੀਕ ਆ ਠੀਕ ਆ ਮੇਰੇ ਹਿਸਾਬ ਨਾਲ ਆਹ ਹੁਣ ਬਾਹਰ ਨਹੀਂ ਪਾਉਂਦੇ ਜੇ ਦੂਨ ਸਕੂਲ ਪਾ ਦਿਓ ਜਾਂ ਫਿਰ ਐੱਚ ਆਰ ਏ ਵਗੈਰਾ ਫਿਰ ਬੱਸਾਂ ਦੇ ਚੱਕਰ ਨਾਲ ਦੂਰ ਜਾਣ ਦਾ ਚੱਕਰ ਪੈਂਦਾ ਵਾ ਤਾਂ ਮੇਰੇ ਹਿਸਾਬ ਨਾਲ ਇੱਕੋ ਕਲਾਸ ਰਹਿ ਗਈ ਆ ਪਲੱਸ ਟੂ ਹੀ ਰਹਿ ਗਈ ਆ ਇੱਥੇ ਕਰਾ ਦਿਓ ਮੇਰੇ ਹਿਸਾਬ ਨਾਲ ਬਾਕੀ ਸਾਰੀ ਤਿਆਰੀ ਬੱਚਿਆਂ ਨੇ ਬਾਅਦ 'ਚ ਕੰਪਟੀਸ਼ਨ ਵਗੈਰਾ ਵਾ ਸਾਰੀ ਗੱਲ ਤਾਂ ਕੰਪੀਟੀਸ਼ਨ 'ਤੇ ਹੀ ਆ ਤੁਸੀਂ ਉਹ ਨਾ ਕਰੋ ਕੋਈ ਗੱਲ ਹਾਂ ਇੱਥੇ ਇੱਥੇ ਪਾ ਦਿਓ ਹਾਂ ਠੀਕ ਹੈ ਜੀ ਓਕੇ ਜੀ ਓਕੇ ਠੀਕ